ਅਸੀਂ ਆਮ ਹੀ ਘਰ ਵਿੱਚ ਬਹੁਤ ਸਾਰੇ ਪਕਵਾਨ ਬਣਾਉਣੇ ਹਾਂ ਰੋਜ਼ਾਨਾ ਜਿਵੇਂ ਦਾਲ ਸਬਜ਼ੀ ਰੋਟੀ ਪਰ ਕਈ ਵਾਰ ਕੋਈ ਖ਼ਾਸ ਰਾਸਪੀ ਅਸੀਂ ਆਪ ਦੇ ਘਰ ਵਿੱਚ ਬਣਾਉਣੇ ਹਾਂ ਜਿਵੇਂ ਇੱਕ ਰਸਪੀ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਬ੍ਰੈਡ ਪਕੌੜਾ ਪਹਿਲਾਂ ਆਲੂ ਉਬਾਲ ਲਵੋ ਅਤੇ ਛਿੱਲ ਲਵੋ ਫਿਰ ਪਿਆਜ ਕੱਟੋ ਉਸ ਵਿੱਚ ਹਰੀ ਮਿਰਚ ਪਾਵਾ ਅਤੇ ਸਵਾਦ ਅਨੁਸਾਰ ਨਮਕ ਮਿਰਚ ਹੋਰ ਵੀ ਜੋ ਚੀਜ਼ ਆਪਣੇ ਅਨੁਸਾਰ ਪਾਉਣੀ ਆ ਉਹ ਪਾ ਲਓ ਫਿਰ ਬਰੈਡ ਕੱਟੋ ਅਤੇ ਉਸ ਦੇ ਵਿੱਚ ਸਾਰਾ ਕੁਝ ਆਲੂ ਪਿਆਜ ਮਿਕਸ ਕਰਕੇ ਭਰ ਦਿਓ ਫਿਰ ਗੈਸ ਉੱਪਰ ਕੜਾਹੀ ਵਿੱਚ ਤੇਲ ਪਾ ਕੇ ਗਰਮ ਕਰੋ ਅਤੇ ਉਸ ਭਰੇ ਹੋਏ ਬ੍ਰੈਡ ਪੋ ਉਸ ਵਿੱਚ ਤਲ ਲਵੋ ਇਸ ਤਰ੍ਹਾਂ ਬਰੈਡ ਪਕੌੜੇ ਬਹੁਤ ਸਵਾਦ ਬਣਦੇ ਹਨ ਜੋ ਅਸੀਂ ਕਦੇ ਕਦੇ ਬਣਾਉਂਦੇ ਹਾਂ